ਪੰਜਾਬ ਵਿੱਚ ਕਈ ਤਰ੍ਹਾਂ ਦੀ ਖੇਤੀਬਾੜੀ ਹੁੰਦੀ ਹੈ ਜਿਵੇਂ ਕੋਈ ਖੇਤੀਬਾੜੀ ਉਗਾਉਂਦੇ ਹਾਂ ਉਹਦੇ ਵਿੱਚ ਸਾਨੂੰ ਬਹੁਤ ਕੈਮੀਕਲ ਵਰਤਣਾ ਹੁੰਦਾ ਉਹ ਪਰ ਕਿਉਂ ਕਿਉਂਕਿ ਸਾਡੇ ਪੰਜਾਬ ਵਿੱਚ ਜ਼ਿਆਦਾ ਸੁੰਡੀ ਪੈਦਾ ਹੋ ਜਾਂਦੀ ਆ ਫਿਰ ਅਸੀਂ ਬਜ਼ਾਰੋਂ ਜਾ ਕੇ ਦਵਾਈਆਂ ਲੈ ਕੇ ਆਉਂਦੇ ਹਾਂ ਉਹ ਹਰ ਇੱਕ ਦਵਾਈ ਵਿੱਚ ਕੈਮੀਕਲ ਹੁੰਦਾ ਹੈ ਜਦੋਂ ਅਸੀਂ ਕੈਮੀਕਲ ਪਾ ਦਿੰਦੇ ਹਾਂ ਤਾਂ ਸਾਡੀ ਜਿਹੜੀ ਆ ਖੇਤੀਬਾੜੀ ਦੇ ਖੇਤਾਂ ਵਿੱਚ ਕਾਫੀ ਉਹ ਉਹਦੀ ਜਿਹੜੀ ਮਿੱਟੀ ਆ ਖਰਾਬ ਹੋ ਜਾਂਦੀ ਹੈ ਕਿਉਂਕਿ ਉਹ ਉਹ ਮਿੱਟੀ ਦੇ ਨਾਲ ਹੀ ਜਦੋਂ ਅਸੀਂ ਖੇਤਾਂ ਵਿੱਚ ਬਿਜਾਈ ਕਰਦੇ ਹਾਂ ਅਤੇ ਉਹ ਬਿਜਾਈ ਕਰਨ ਤੋਂ ਪੈਦਾ ਹੋਣ ਤੋਂ ਬਾਅਦ ਫਸਲਾਂ ਵਿੱਚ ਜਦੋਂ ਅਸੀਂ ਖਾਂਦੇ ਹਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਇਸ ਲਈ ਸਾਨੂੰ ਉਹ ਜ਼ਰੂਰੀ ਪਾਉਣਾ ਪੈਂਦਾ ਹੈ ਕਿਉਂਕਿ ਉਹ ਕਾਫੀ ਤਰ੍ਹਾਂ ਦੀ ਸੁੰਡੀ ਪੈਦਾ ਹੋ ਜਾਂਦੀ ਹੈ ਤਾਂ ਅਸੀਂ ਉਹਨੂੰ ਫਸਲਾਂ ਬਚਾਉਣ ਵਾਸਤੇ ਸਾਨੂੰ ਕੈਮੀਕਲ ਦਵਾਈਆਂ ਤਾਂ ਵਰਤਣੀਆਂ ਹੀ ਪੈਂਦੀਆਂ ਹਨ ਪਹਿਲੇ ਸਮੇਂ ਤੋਂ ਪਹਿਲੋਂ ਜਦੋਂ ਸਾਡੇ ਬਜ਼ੁਰਗ ਲੋਕ ਖੇਤੀਬਾੜੀ ਕਰਦੇ ਸੀ ਉਹ ਖੇਤਾਂ ਵਿੱਚ ਐਦਾਂ ਕਰਦੇ ਸੀ ਜਿਵੇਂ ਰੂੜੀ ਪਾਤੀ ਰੂੜੀ ਪਾਤੀ ਜਾਂ ਜਿਵੇਂ ਅਸੀਂ ਮੁਰਗੀਖਾਨੇ ਦੇ ਵਿੱਚ ਬਿੱਠਾਂ ਪਾਤੀਆਂ ਉਸ ਟਾਈਮ 'ਤੇ ਇਹੋ ਜਿਹੀ ਕੋਈ ਬਿਮਾਰੀ ਨਹੀਂ ਬਿਮਾਰੀ ਨਹੀਂ ਹੁੰਦੀ ਸੀ ਕੋਈ ਸੁੰਡੀ ਵੀ ਨਹੀਂ ਹੁੰਦੀ ਸੀ ਅਤੇ ਨਾ ਕੋਈ ਕੈਮੀਕਲ ਵਰਤਿਆ ਜਾਂਦਾ ਸੀ ਇਸ ਲਈ ਅਸੀਂ ਕਹਿੰਦੇ ਹਾਂ ਵੀ ਜੇ ਕਿਸੇ ਨੂੰ ਆਦਮੀ ਨੂੰ ਇਹੋ ਜਿਹੀ ਕੋਈ ਸਕੀਮ ਆਜੇ ਜਾਂ ਇਹੋ ਜਿਹੀ ਕੋਈ ਗੱਲ ਹੋਜੇ ਵੀ ਸਾਨੂੰ ਕੈਮੀਕਲ ਤੋਂ ਬਿਲਕੁਲ ਹੀ ਛੁਟਕਾਰਾ ਮਿਲਜੇ ਤਾਂ ਸਾਨੂੰ ਇਹ ਕੈਮੀਕਲ ਦੀਆਂ ਚੀਜ਼ਾਂ ਘੱਟ ਵਰਤਣੀਆਂ ਚਾਹੀਦੀਆਂ ਹਨ ਅਤੇ ਸਾਨੂੰ ਵੱਧ ਤੋਂ ਵੱਧ ਰੂੜੀ ਅਤੇ ਜਾਂ ਮੁਰਗੀਖਾਨੇ ਦੀ ਬਿੱਠਾਂ ਪਾਉਣੀਆਂ ਚਾਹੀਦੀਆਂ ਹਨ